ਕਢਾਈ ਵੱਖ ਵੱਖ ਤਰ੍ਹਾਂ ਦੀ ਹੁੰਦੀ ਹੈ ਇਹ ਆਮ ਤੌਰ 'ਤੇ ਦੁਪੱਟਿਆਂ ਫੁਲਕਾਰੀਆਂ ਜਾਂ ਸੂਟਾਂ 'ਤੇ ਕੀਤੀ ਜਾਂਦੀ ਹੈ ਬਟ ਸਭ ਤੋਂ ਜ਼ਿਆਦਾ ਇਹ ਫੁਲਕਾਰੀਆਂ ਦੇ ਉੱਤੇ ਕੀਤੀ ਜਾਂਦੀ ਹੈ ਇਸ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਟਾਂਕੇ ਜਿਹੜੇ ਲਗਾਏ ਜਾਂਦੇ ਹਨ ਜਿਸ ਨੂੰ ਜਿਵੇਂ ਕਿ ਸੈਮੀ ਸਟਿਚ ਕੱਚੇ ਟਾਂਕੇ ਪੱਕੇ ਟਾਂਕੇ ਛੋਟੇ ਟਾਂਕੇ 'ਤੇ ਸੈਟਲ ਸਟੈਚਿਜ ਫੁਲਕਾਰੀ ਅੱਜ ਦੀ ਕਢਾਈ ਦੇ ਵਿੱਚ ਜਦੋਂ ਆਪਾਂ ਹੈਵੀ ਕਢਾਈ ਕਰਦੇ ਆ ਉਸ ਦੇ ਵਿੱਚ ਸਾਡਾ ਸਟੇਚਿਜ ਲਗਾਈਆਂ ਜਾਂਦੀਆਂ ਨੇ ਅਤੇ ਮੈਂ ਕੱਚਿਆਂ ਟਾਂਕਿਆਂ ਦੀ ਕਢਾਈ ਬਹੁਤ ਚੰਗੀ ਤਰ੍ਹਾਂ ਕਰ ਲੈਂਦੀ ਹਾਂ ਜਿਸ ਦੇ ਨਾਲ ਮੈਂ ਆਪਣੀ ਇੱਕ ਫੁਲਕਾਰੀ ਵੀ ਬਣਾਈ ਹੈ